ਮੇਰਾ ਨਾਮ ਅਰਾਧਨਾ ਹੈ ਮੈ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਤੁਸੀਂ ਸਾਨੂੰ ਇਹ ਪੁੱਛਿਆ ਹੈ ਕਿ ਪਰਿਵਾਰ ਨਾਲ ਰਸੋਈ ਨੂੰ ਕਿਵੇਂ ਸਾਂਝਾ ਕੀਤਾ ਜਾ ਸਕਦਾ ਹੈ ਦੇਖੋ ਜੀ ਪਰਿਵਾਰ ਨਾਲ ਰਸੋਈ ਨੂੰ ਇਸ ਤਰ੍ਹਾਂ ਸਾਂਝਾ ਕੀਤਾ ਜਾ ਸਕਦਾ ਹੈ ਕਿ ਅਸੀਂ ਸਭ ਪਰਿਵਾਰ ਮਿਲ ਜੁਲ ਕੇ ਕੰਮ ਕਰ ਸਕਦੇ ਹਾਂ ਜੇਕਰ ਅਸੀਂ ਗੱਲ ਕਰੀਏ ਪਰਿਵਾਰ ਨਾਲ ਮੇਲ ਮਿਲਾਪ ਦੇ ਆਪਣੇ ਵਿਚਾਰਾਂ ਨੂੰ ਸਾਂਝੇ ਕਰਨ ਦੀ ਤਾਂ ਸਾਨੂੰ ਆਪਣੇ ਪਰਿਵਾਰ ਕੋਲੋਂ ਅੱਛੇ ਅੱਛੇ ਵਿਚਾਰ ਮਿਲ ਸਕਦੇ ਹਨ ਜਿਸ ਨਾਲ ਅਸੀਂ ਹੋਰ ਵੀ ਆਪਣਾ ਕੰਮ ਵਧੀਆ ਕਰ ਸਕਦੇ ਹਾਂ ਜਦੋਂ ਅਸੀਂ ਕੁਛ ਵੀ ਕੰਮ ਰਸੋਈ ਵਿੱਚ ਕਰਦੇ ਹਾਂ ਜਿਵੇਂ ਤੁਸੀਂ ਖਾਣਾ ਬਣਾਉਣ ਦੀ ਹੀ ਗੱਲ ਲੈ ਲਓ ਜਦੋਂ ਅਸੀਂ ਖਾਣਾ ਬਣਾਉਂਦੇ ਹਾਂ ਤਾਂ ਹਰ ਇੱਕ ਦੈ ਦੀ ਸਲਾਹ ਹੁੰਦੀ ਹੈ ਕਿ ਅੱਜ ਇਹ ਬਣਾਇਆ ਜਾਏ ਅੱਜ ਉਹ ਬਣਾਇਆ ਜਾਏ ਜਿਸ ਕਾਰਨ ਸਾਨੂੰ ਥੋੜ੍ਹਾ ਜਿਹਾ ਹੋਰ ਵੀ ਜ਼ਿਆਦਾ ਪਤਾ ਚਲਦਾ ਹੈ ਕਿ ਖਾਣਾ ਕਿਸ ਤਰ੍ਹਾਂ ਚੰਗਾ ਬਣ ਸਕਦਾ ਹੈ ਜਦੋਂ ਵੀ ਖਾਣਾ ਚੰਗਾ ਬਣਦਾ ਹੈ ਤਾਂ ਸਾਡੇ ਪਰਿਵਾਰ ਦੇ ਲੋਕ ਬਹੁਤ ਹੀ ਖੁਸ਼ ਹੁੰਦੇ ਹਨ ਜਦੋਂ ਅਸੀਂ ਪਰਿਵਾਰ ਨਾਲ ਆਪਣੇ ਇਸ ਵਿਚਾਰ ਸਾਂਝੇ ਕਰਦੇ ਹਾਂ ਤਾਂ ਵਿਚਾਰਾਂ ਵਿੱਚੋਂ ਇਹ ਵੀ ਗੱਲ ਨਿਕਲਦੀ ਹੈ ਕਿ ਹਰ ਪਰਿਵਾਰ ਹਰ ਇਕ ਸਦੱਸਅ ਦਾ ਆਪਣਾ ਆਪਣਾ ਵਿਚਾਰ ਹੁੰਦਾ ਹੈ ਹਰ ਇਕ ਕੋਈ ਸਦੱਸਅ ਆਪਣੇ ਆਪਣੇ ਵਿਚਾਰ ਸਾਰਿਆਂ ਅੱਗੇ ਰੱਖਦਾ ਹੈ ਕਿ ਅੱਜ ਤੁਸੀਂ ਇਹ ਬਣਾਓ ਦੂਸਰਾ ਕਹਿੰਦਾ ਅੱਜ ਤੁਸੀਂ ਕੁਛ ਹੋਰ ਬਣਾਓ ਜਦੋਂ ਅਸੀਂ ਉਹਨਾਂ ਦੀ ਸਲਾਹ ਮੰਨਦੇ ਹਾਂ ਤਾਂ ਅਸੀਂ ਰਲ ਮਿਲ ਕੇ ਸਾਰੇ ਜਣੇ ਕੁਛ ਨਾ ਕੁਛ ਅੱਛਾ ਬਣਾ ਚੰਗਾ ਬਣਾਉਂਦੇ ਹਾਂ ਜਦੋਂ ਅਸੀਂ ਇਹ ਕੁਝ ਬਣਾਉਂਦੇ ਹਾਂ ਤਾਂ ਪਰਿਵਾਰ ਵਿੱਚ ਅਸੀਂ ਰਹਿ ਕੇ ਸਾਰੇ ਇੱਕ ਰਸੋਈ ਵਿੱਚ ਸਾਰੇ ਇਕੱਠੇ ਹੋ ਕੇ ਆਪਣਾ ਆਪਣਾ ਕੰਮ ਕਰਦੇ ਹਾਂ ਜਦੋਂ ਅਸੀਂ ਇਹ ਕੰਮ ਸਾਰੇ ਇਕੱਠੇ ਕਰਾਂਗੇ ਤਾਂ ਸਾਡਾ ਜਿਹੜਾ ਕੰਮ ਹੈ ਜਿਹੜਾ ਕੰਮ ਸਾਡਾ ਘੰਟੇ ਦੇ ਵਿੱਚ ਹੋਣਾ ਹੈ ਉਹ ਕੰਮ ਸਾਡਾ ਬਹੁਤ ਹੀ ਜਲਦੀ ਅਤੇ ਅੱਧੇ ਪੋਣੇ ਘੰਟੇ ਵਿੱਚ ਹੀ ਹੋ ਜਾਵੇਗਾ ਦੇਖੋ ਜਦੋਂ ਅਸੀਂ ਸਾਰਾ ਕੰਮ ਸਾਰੇ ਜਣੇ ਰਲ ਕੇ ਕਰਾਂਗੇ ਤਾਂ ਉਹ ਕੰਮ ਇੰਨੀ ਕੁ ਜਲਦੀ ਹੋਏਗਾ ਕਿ ਸਾਨੂੰ ਟਾਈਮ ਸਮੇਂ ਦਾ ਪਤਾ ਵੀ ਨਹੀਂ ਲੱਗੇਗਾ